ਚਾਰ ਸੌ ਪੰਤਾਲੀ ਪੰਜ ਹਜ਼ਾਰ ਚਾਰ ਸੌ ਅਠਤਾਲੀ ਦਸ ਹਜ਼ਾਰ ਨੌ ਸੌ ਪਚਾਨਵੇਂ ਅੱਸੀ ਹਜ਼ਾਰ ਦੋ ਸੌ ਅੱਸੀ ਨੌ ਲੱਖ ਪੰਜ ਹਜ਼ਾਰ ਨੌਂ ਸੌ ਨੜ੍ਹਿਨਵੇਂ